ਪੰਜਾਬ ਵਿੱਚ ਭੰਗੜੇ ਦੀ ਆਪਣੀ ਇੱਕ ਵੱਖਰੀ ਹੀ ਮਹੱਤਤਾ ਹੈ ਜੋ ਕਿਸੇ ਵੀ ਖੁਸ਼ੀ ਦੇ ਮੌਕੇ ਨੂੰ ਦੂਣਾ ਕਰਨ ਜਾਂ ਇੰਝ ਕਹਿ ਲਓ ਕਿ ਆਪਣੀ ਖੁਸ਼ੀ ਨੂੰ ਦਰਸਾਉਣ ਵਿੱਚ ਸਹਾਈ ਹੁੰਦਾ ਹੈ ਭੰਗੜਾ ਸਿਰਫ ਪੰਜਾਬ ਵਿੱਚ ਹੀ ਪ੍ਰਚਿਲਤ ਨਾ ਹੋ ਕੇ ਸਗੋਂ ਦੁਨੀਆ ਭਰ ਵਿੱਚ ਬੜੇ ਹੀ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਜੋ ਕਿ ਦੇਸ਼ ਦੇ ਕਿਸੇ ਵੀ ਕੋਨੇ ਵਿੱਚ ਹੋ ਰਹੇ ਕਿਸੇ ਵੀ ਵਰਗ ਦੇ ਪ੍ਰੋਗਰਾਮ ਜਾਂ ਖੁਸ਼ੀ ਦੇ ਮੌਕੇ ਨੂੰ ਵੱਖਰਾ ਹੀ ਚਾਰ ਚੰਨ ਲਾ ਦਿੰਦਾ ਹੈ